ਹੈਲੋ ਹੈਲੋ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਕਿਆ ਹਾਲ ਹੈ ਵਧੀਆ ਬਸ ਵ ਘਰ ਦੇ ਕੰਮ 'ਚ ਪੜ੍ਹਾਈ 'ਚ ਬਸ ਇਹ 'ਚ ਵਿਅਸਤ

ਹਾਂ ਉਹ ਤਾਂ ਹੈ ਹਾਂ ਜਿੱਦਾਂ ਬੱਚਿਆਂ ਨੂੰ ਵੀ ਲੇਟ ਹੋ ਜਾਂਦਾ ਸਕੂਲ ਜਾਣਾ ਹੋਏ ਕਿਸੇ ਨੇ ਔਫਿਸ ਜਾਣਾ ਹੋਏ ਤਾਂ ਵੀ ਲੇਟ ਹੋ ਜਾਂਦਾ ਇਹ ਟਰੈਫਿਕ ਬੜਾ ਹੀ ਜ਼ਿਆਦਾ ਹੋ ਗਿਆ ਹੁਣ ਸਾਡੇ ਪਠਾਨਕੋਟ 'ਚ ਜੀ ਜੀ ਜੀ ਚਲੋ ਠੀਕ ਹੈ